ਵਹਿਮ ਹਾਂਜੀ ਵਹਿਮ ਤਾਂ ਬਹੁਤ ਨੇ ਅੱਜ ਕੱਲ੍ਹ ਔਰ ਵਹਿਮਾਂ ਦੀ ਹਕੀਕਤ ਵੀ ਆ ਕਿਉਂਕਿ ਪਹਿਲਾਂ ਜਿਹੜੇ ਲੋਕ ਵਹਿਮ ਪੁਰਾਣੇ ਟਾਈਮ 'ਤੇ ਜਿਹੜੀਆਂ ਔਰਤਾਂ ਕਰਦੀਆਂ ਸੀ ਉਹ ਤਾਂ ਬਹੁਤ ਵਹਿਮ ਕਰਦੀਆਂ ਸੀ ਔਰ ਔਰ ਵਹਿਮ ਸੱਚੀ ਵੀ ਹੁੰਦੇ ਸੀ ਪਰ ਅੱਜ ਮਤਲਬ ਪਹਿਲਾਂ ਕਹਿੰਦੇ ਸੀ ਕਿ ਜੀ ਜਿ ਜਿੱਦਾਂ ਔਰਤ ਨੂੰ ਮਾਨਸਿਕ ਮਹਾਵਾਰੀ ਸ਼ੁਰੂ ਹੁੰਦੀ ਹੈ ਅਤੇ ਉਹਨੂੰ ਰਸੋਈ ਘਰ ਵਿੱਚ ਨਹੀਂ ਜਾਣ ਦਿੰਦੇ ਅਤੇ ਇੱਕ ਵਹਿਮ ਹੈ ਔਰ ਪਰ ਅੱਜ ਕੱਲ੍ਹ ਇਹ ਵਹਿਮ ਨਹੀਂ ਮੰਨਿਆ ਜਾਂਦਾ ਪਹਿਲਾਂ ਟਾਈਮ 'ਤੇ ਇਹਨੂੰ ਅਸ਼ੁੱਧ ਮੰਨਿਆ ਜਾਂਦਾ ਸੀ ਇਹ ਇੱਕ ਇੱਕ ਟਾਇਪ ਦਾ ਵਹਿਮ ਹੀ ਹੋ ਗਿਆ ਪਰ ਅੱਜ ਕੱਲ੍ਹ ਨਹੀਂ ਇਹ ਵਹਿਮ ਮੰਨਦੇ ਅੱਜ ਕੱਲ੍ਹ ਤਾਂ ਕਹਿੰਦੇ ਕੋਈ ਗੱਲ ਨਹੀਂ ਇਸ ਤੋਂ ਵਗੈਰ ਗੁਜ਼ਾਰਾ ਨਹੀਂ ਆ ਅਗਰ ਕਿਚਨ 'ਚ ਨਹੀਂ ਜਾਵਾਂਗੇ ਤਾਂ ਅਸੀਂ ਕੌਣ ਰੋਟੀ ਬਣਾਏਗਾ ਇਸ ਕਰਕੇ ਅੱਜ ਕੱਲ੍ਹ ਤਾਂ ਵਹਿਮ ਇਹ ਵਾਲਾ ਨਹੀਂ ਹੈਗਾ ਲੇਕਿਨ ਫਿਰ ਵੀ ਮੇਰੇ ਘਰ 'ਚ ਜਿੱਦਾਂ ਮੈਂ ਵਿਆਹੀ ਹਾਂ ਮੇਰੀ ਸੱਸ ਤਾਂ ਬਹੁਤ ਵਹਿਮ ਕਰਦੀ ਆ ਇਸ ਗੱਲ ਤੋਂ ਉਹ ਮੈਨੂੰ ਕਹਿੰਦੇ ਨੇ ਕਿ ਤੁਸੀਂ ਜੇ ਰਸਤੇ ਵਿੱਚ ਜਾਂਦੇ ਪਏ ਨਾ ਜੇ ਚੁਰਸਤੇ ਵਿੱਚ ਕੋਈ ਚੀਜ਼ ਪਈ ਆ ਕੀਤੀ ਆ ਤਾਂ ਉਹਨੂੰ ਲੰਘਣਾ ਟੱਪਣਾ ਨਹੀਂ ਲੋਕ ਉੱਥੇ ਜਾਦੂ ਟੂਣਾ ਕਰ ਜਾਂਦੇ ਆ ਓਥੇੇ ਕੋਈ ਨੇ ਤਾਲਾ ਰੱਖ ਦੇਣਾ ਕਿਸੇ ਨੇ ਝਾੜੂ ਰੱਖ ਦੇਣਾ ਖੋਲ੍ਹ ਕੇ ਕਿਸੇ ਨੇ ਕੁਛ ਰੱਖ ਦੇਣਾ ਕਿਸੇੇ ਨੇ ਟਿੱਕਾ ਉਹ ਬ 'ਤੇ ਤਿਵ ਕਰਕੇ ਮੌਲੀਆਂ ਬੰਨ੍ਹ ਬੰਨ੍ਹ ਕੇ ਨਾਰੀਅਲ ਦੇ ਉੱਪਰ ਤਿਲਕ ਲਾ ਕੇ ਇੱਦਾਂ ਰੱਖ ਦਿੰਦੇ ਆ ਅਤੇ ਉਹ ਅਸੀਂ ਜੇ ਮੰਨ ਲਓ ਅਸੀਂ ਟੱਪਦੇ ਹਾਂ ਅਤੇ ਸਾਨੂੰ ਕੁਛ ਨਾ ਕੁਛ ਤਾਂ ਅਸਰ ਹੋਏਗਾ ਇਸ ਕਰਕੇ ਸਾਨੂੰ ਇਹ ਚੀਜ਼ਾਂ ਤੋਂ ਵਹਿਮ ਹੈਗੇ ਵੀ ਹੈ ਸਾਨੂੰ ਇਹਨਾਂ ਦਾ ਪਰਹੇਜ਼ ਕਰਨਾ ਚਾਹੀਦਾ ਜਿੱਥੇ ਸਾਨੂੰ ਇਹੋ ਜਿਹੀ ਚੀਜ਼ਾਂ ਲੱਗਣ ਸਾਨੂੰ ਥੋੜ੍ਹਾ ਜਿਹਾ ਦੇਖ ਲੈਣਾ ਚਾਹੀਦਾ ਕਿ ਅਸੀਂ ਇਹਨੂੰ ਟੱਪੀਏ ਨਾ ਲੰਘੀਏ ਨਾ ਤਾਂ ਕਿ ਐ ਸਾਡੀ ਕੋਈ ਅਸਰ ਨਾ ਹੋਵੇ ਇਹਦਾ ਬੇ ਅਸਰ ਨਾ ਹੋਵੇ ਕੋਈ ਇਹਦਾ ਮਤਲਬ ਨੁਕਸਾਨ ਨਾ ਹੋਵੇ ਇਸ ਕਰਕੇ ਸਾਨੂੰ ਥੋੜ੍ਹਾ ਵਹਿਮਾਂ ਨੂੰ ਵੇਖਣਾ ਵੀ ਚਾਹੀਦਾ ਜ਼ਿਆਦਾ ਨਹੀਂ ਕਰਨੇ ਚਾਹੀਦੇ ਲੇਕਿਨ ਇਹ ਚੀਜ਼ਾਂ ਜਿਹੜੇ ਮੈਂ ਤੁਹਾਨੂੰ ਦੱਸੀਆਂ ਨੇ ਇਹ ਥੋੜ੍ਹਾ ਬੰਦੇ ਨੂੰ ਦੇਖ ਲੈਣਾ ਚਾਹੀਦਾ ਕਿ ਅਸੀਂ ਚੀਜ਼ਾਂ ਟੱਪ ਲੰਘ ਕੇ ਨਾ ਜਾਈਏ